ਸਤਿ ਸ਼੍ਰੀ ਅਕਾਲ ਪੰਜਾਬ ਦਾ ਕੁਦਰਤੀ ਲੈਂਡਸਕੇਪ ਇਸਦੀ ਜਮੀਨ ਉਪਜਾਊ ਖੇਤਰਾਂ ਨਦੀਆਂ ਅਤੇ ਖੂਬਸੂਰਤ ਦ੍ਰਿਸ਼ ਨਾਲ ਵੱਖਰਾ ਹੈ ਪੰਜਾਬ ਨੂੰ ਪੰਜ ਆਬ ਦੀ ਧਰਤੀ ਵੀ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਪੰਜ ਨਦੀਆਂ ਦੀ ਧਰਤੀ ਇਹ ਨਦੀਆਂ ਇਸ ਖੇਤਰ ਨੂੰ ਬਹੁ ਉਤ ਉਪਜਾਊ ਬਣਾਉਂਦੀਆਂ ਹਨ ਅਤੇ ਇਸ ਦੇ ਕੁਦਰਤੀ ਦ੍ਰਿਸ਼ ਨੂੰ ਵੀ ਸੁੰਦਰ ਬਣਾਉਂਦੀਆਂ ਹਨ ਪਹਿਲਾ ਮਾਲਵਾ ਪੰਜਾਬ ਦੇ ਦੱਖਣੀ ਭਾਰਤ ਵਿੱਚ ਸਥਿਤ ਮਾਲਵਾ ਇਲਾਕਾ ਆਪਣੀ ਉਪਜਾਊ ਜਮੀਨਾਂ ਲਈ ਜਾਣਿਆ ਜਾਂਦਾ ਹੈ ਇੱਥੇ ਦੇ ਵੱਡੇ ਖੇਤਰਾਂ ਵਿੱਚ ਗੇਹੂੰ ਨਰਮਾ ਅਤੇ ਹੋਰ ਫ਼ਸਲਾਂ ਦੀ ਖੇਤੀ ਕੀ ਹੁੰਦੀ ਹੈ ਦੂਸਰਾ ਮਾਝਾ ਪੰਜਾਬ ਦੇ ਖੇਤ ਕੇਂਦਰੀ ਭਾਗ ਵਿੱਚ ਸਥਿਤ ਮਾਝਾ ਇਲਾਕਾ ਅੰਮ੍ਰਿਤਸਰ ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ ਇੱਥੇ ਦੇ ਦੀ ਜਮੀਨ ਵੀ ਬਹੁਤ ਉਪਜਾਊ ਹੈ ਅਤੇ ਇੱਥੇ ਚੋਲ ਗੇਹੂੰ ਅਤੇ ਸਬਜ਼ੀਆਂ ਦੀ ਖੇਤੀ ਬਹੁਤ ਹੁੰਦੀ ਹੈ ਦੁਆਬਾ ਦੋ ਅਰ ਦੋ ਆਬ ਦਾ ਅਰਥ ਹੈ ਦੋ ਪਾਣੀਆਂ ਦੇ ਵਿੱਚਕਾਰ ਜੋ ਬਿਆਸ ਅਤੇ ਸਤਲੁਜ ਨਦੀਆਂ ਦੇ ਵਿਚਕਾਰ ਸਥਿਤ ਹੈ ਦੁਆਬਾ ਖੇਤਰ ਸਿਸ ਕਰਕੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਫੈਲਿਆ ਹੋਇਆ ਹੈ ਇਹ ਇਲਾਕਾ ਆਪਣੀ ਉਪਜਾਊ ਜਮੀਨ ਲਈ ਮਸ਼ਹੂਰ ਹੈ ਅਤੇ ਇੱਥੇ ਆਲੂ ਚੋਲ ਸਬਜ਼ੀਆਂ ਅਤੇ ਫ਼ਲਾਂ ਦੀ ਖੇਤੀ ਹੁੰਦੀ ਹੈ ਧੰਨਵਾਦ ਜੀ